ਬਾਈਕਿੰਗ ਵੱਲ ਮੇਰਾ ਰੁਝਾਅ ਬਹੁਤ ਜ਼ਿਆਦਾ ਹੈ ਮੈਨੂੰ ਲੱਗਦਾ ਹੈ ਕਿ ਬਾਈਕਿੰਗ ਲੋਕਾਂ ਦੇ ਜੀਵਨ ਅਤੇ ਭਾਈਚਾਰਿਆਂ 'ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ ਬਾਈਕਿੰਗ ਯਾਤਾਯਾਤ ਦਾ ਬਹੁਤ ਹੀ ਸੁਵਿਧਾਜਨਕ ਸਾਧਨ ਹੈ ਬਾਈਕ ਨਾਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਬਹੁਤ ਹੀ ਆਸਾਨ ਹੈ ਸ਼ਹਿਰਾਂ ਦੇ ਭੀੜ ਭੜੱਕੇ ਵਿੱਚੋਂ ਜਿੱਥੇ ਗੱਡੀ ਦਾ ਹੀ ਜਾਣ ਨਾਲ ਬਹੁਤ ਦਿੱਕਤ ਹੁੰਦੀ ਹੈ ਉੱਥੇ ਹੀ ਬਾਈਕ ਆਪਣੇ ਛੋਟੇ ਆਕਾਰ ਹੋਣ ਕਾਰਨ ਬੜੇ ਹੀ ਆਰਾਮ ਨਾਲ ਨਿਕਲ ਜਾਂਦੀ ਹੈ ਪਤਲੀ ਪਤਲੀ ਗਲੀਆਂ ਜਿੱਥੇ ਬੰਦਾ ਗੱਡੀ ਲਿਜਾਣ ਦੀ ਸੋਚ ਵੀ ਨਹੀਂ ਸਕਦਾ ਉਹਨਾਂ ਥਾਂਵਾਂ 'ਤੇ ਬਾਈਕ ਦਾ ਹੋਣਾ ਕਿਸੇ ਵਰਦਾਨ ਤੋਂ ਘੱਟ ਨਹੀਂ ਬਾਈਕਿੰਗ ਨਾਲ ਸਮੇਂ ਦੀ ਬਹੁਤ ਬਚਤ ਹੁੰਦੀ ਹੈ ਜਿਹੜਾ ਰਸਤਾ ਮਨੁੱਖ ਪੈਦਲ ਇੱਕ ਘੰਟੇ ਵਿੱਚ ਪਾਰ ਕਰਦਾ ਹੈ ਉਹੀ ਰਸਤਾ ਬਾਈਕ ਨਾਲ ਦਸਾਂ ਮਿੰਟਾਂ ਵਿੱਚ ਹੀ ਪਾਰ ਹੋ ਜਾਂਦਾ ਹੈ ਬਾਈਕਿੰਗ ਨੇ ਆਮ ਲੋਕਾਂ ਦੇ ਜੀਵਨ ਬਹੁਤ ਸੁਖਾਲਾ ਕਰ ਦਿੱਤਾ ਹੈ ਇਸ ਨਾਲ ਆਪਸੀ ਭਾਈਚਾਰੇ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ ਮਨੁੱਖ ਮਿੰਟਾਂ ਵਿੱਚ ਹੀ ਆਪਣੇ ਭਰਾਵਾਂ ਦੋਸਤਾਂ ਮਿੱਤਰਾਂ ਕੋਲ ਪਹੁੰਚ ਜਾਂਦਾ ਹੈ ਇਸ ਨਾਲ ਆਉਣ ਜਾਣ ਬਣਿਆ ਰਹਿੰਦਾ ਹੈ ਅਤੇ ਆਪਸੀ ਸਾਂਝ ਅਤੇ ਭਾਈਚਾਰੇ ਵਿੱਚ ਬਹੁਤ ਵਾਧਾ ਹੁੰਦਾ ਹੈ ਕਦੇ ਵੀ ਕਿਸੇ ਨੂੰ ਵੀ ਕੋਈ ਵੀ ਲੋੜ ਪੈ ਜਾਵੇ ਤਾਂ ਬਾਈਕ ਦੇ ਹੋਣ ਨਾਲ ਮਨੁੱਖ ਬਹੁਤ ਜਲਦੀ ਉਸ ਥਾਂ 'ਤੇ ਪਹੁੰਚ ਸਕਦਾ ਹੈ ਬਾਈਕ 'ਤੇ ਪੈਟਰੋਲ ਦਾ ਖਰਚਾ ਵੀ ਗੱਡੀ ਨਾਲੋਂ ਬਹੁਤ ਘੱਟ ਹੁੰਦਾ ਹੈ ਬਾਈਕਿੰਗ ਦਾ ਲੋਕ ਘੁੰਮਣ ਬਾਈਕਿੰਗ ਦਾ ਇਸਤੇਮਾਲ ਲੋਕ ਘੁੰਮਣ ਲਈ ਵੀ ਬਹੁਤ ਜ਼ਿਆਦਾ ਕਰਦੇ ਹਨ ਬਾਈਕਿੰਗ ਕਰਨ ਨਾਲ ਮਨੁੱਖ ਅਲੱਗ ਅਲੱਗ ਥਾਵਾਂ 'ਤੇ ਜਾਂਦਾ ਹੈ ਜਿਸ ਨਾਲ ਉਹ ਭਾਰਤ ਦੇ ਵੱਖ ਵੱਖ ਇਲਾਕਿਆਂ ਦੇ ਸਭਿਆਚਾਰ ਨੂੰ ਦੇਖਦਾ ਹੈ ਅਤੇ ਉੱਥੋਂ ਦੇ ਰਿਵਾਜ਼ਾਂ ਨੂੰ ਸਮਝਦਾ ਹੈ ਇਸ ਨਾਲ ਮਨੁੱਖ ਨੂੰ ਆਪਣੇ ਆਲੇ ਦੁਆਲੇ ਦਾ ਪਤਾ ਲੱਗਦਾ ਰਹਿੰਦਾ ਹੈ ਅਤੇ ਭਿੰਨ ਭਿੰਨ ਪ੍ਰਕਾਰ ਦੇ ਸਭਿਆਚਾਰ ਬਾਰੇ ਜਾਣਕਾਰੀ ਮਿਲਦੀ ਹੈ ਇਸ ਨਾਲ ਦੂਰ ਦੁਰਾਡੇ ਦੇ ਲੋਕਾਂ ਨਾਲ ਵੀ ਭਾਈਚਾਰਕ ਸਾਂਝ ਵਿੱਚ ਬਹੁਤ ਵਾਧਾ ਹੁੰਦਾ ਹੈ